ਕਿਤਾਬਾਂ ਖਰੀਦਣ ਅਗਰ ਖਰੀਦਣ ਦੀ ਆਪਾਂ ਗੱਲ ਕਰੀਏ ਤਾਂ ਕਿਤਾਬਾਂ ਪੱਖੋਂ ਮੈਨੂੰ ਧਾਰਮਿਕ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਿਆਦਾ ਵਧੀਆ ਲਗਦੀਆਂ ਹਨ ਜੀ ਇਸ ਕਰਕੇ ਸਾਡੇ ਸ਼੍ਰੀ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਸਾਡੇ ਅਸੀਂ ਉੱਥੇ ਗੁਰਦੁਆਰਾ ਸਾਹਿਬ ਤੋਂ ਬਾਹਰ ਸਾਨੂੰ ਬੀਬੀ ਇੰਦਰਜੀਤ ਕੌਰ ਦੀ ਹੱਥ ਲਿਖਤ ਕਿਤਾਬਾਂ ਮਿਲ ਜਾਂਦੀਆਂ ਹਨ ਭਗਤ ਪੂਰਨ ਸਿੰਘ ਬਾਰੇ ਬਹੁਤ ਕਿਤਾਬਾਂ ਮਿਲਦੀਆਂ ਹਨ ਬਹੁਤ ਧਾਰਮਿਕ ਕਿਤਾਬਾਂ ਉੱਥੇ ਲਾਇਬ੍ਰੇਰੀ ਬਣੀ ਹੋਈ ਹੈ ਜੀ ਉੱਥੇ ਸਾਨੂੰ ਮਿਲਦੀਆਂ ਹਨ ਔਰ ਮੈਂ ਉੱਥੋਂ ਹੀ ਕਿਤਾਬਾਂ ਲੈ ਕੇ ਜਾਣਾ ਪਸੰਦ ਕਰਦਾ ਹਾਂ ਧਾਰਮਿਕ ਕਿਤਾਬਾਂ ਪ ਪੜ੍ਹਦਾ ਹਾਂ ਅਗਰ ਸ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਸਾਨੂੰ ਸੈਕਿੰਡ ਹੈਂਡ ਕਿਤਾਬਾਂ ਇੱਥੇ ਸਾਡੇ ਬੁੱਕ ਸਟੋਰ ਕਾਫ਼ੀ ਬਣੇ ਹਨ ਜਿਵੇਂ ਕਿ ਕੱਕੜ ਬੁੱਕ ਹਾਊਸ ਹਰਭਜਨ ਬੁੱਕ ਸਟੋਰ ਸਾਡੇ ਰੋਪੜ 'ਚ ਹਨ ਜਿੱਥੋਂ ਕਿ ਸਾਨੂੰ ਪੁਰਾਣੀਆਂ ਇਤਿਹਾਸਿਕ ਕਿਤਾਬਾਂ ਮਿਲ ਜਾਂਦੀਆਂ ਹਨ ਔਰ ਸਾਡੇ ਸਰਕਾਰੀ ਕਾਲਜ ਰੋਪੜ ਵਿਖੇ ਲਾਇਬ੍ਰੇਰੀ ਹੈ ਜਿੱਥੋਂ ਅਸੀਂ ਕਿਤਾਬਾਂ ਲੈ ਸਕਦੇ ਹਾਂ ਔਰ ਮੈਂ ਕਿਤਾਬਾਂ ਉੱਥੋਂ ਲੈਂਦਾ ਵੀ ਹਾਂ ਔਰ ਸਾਨੂੰ ਉੱਥੋਂ ਕਿਤਾਬਾਂ ਬਹੁਤ ਵਧੀਆ ਮਿਲਦੀਆਂ ਹਨ ਜੋ ਸਾਨੂੰ ਆਪਣੀ ਪਸੰਦ ਦੀਆਂ ਕਿਤਾਬਾਂ ਚਾਹੀਦੀਆਂ ਹੁੰਦੀਆਂ ਹਨ ਸਾਨੂੰ ਮਿਲ ਜਾਂਦੀਆਂ ਹਨ ਇ ਇਸ ਕਰਕੇ ਮੈਂ ਉੱਥੇ ਕਿਤਾਬਾਂ ਪੜ੍ਹਨ ਲੈ ਕੇ ਜਾਣੀਆਂ ਪਸੰਦ ਕਰਦਾ ਹਾਂ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਲਾਇਬ੍ਰੇਰੀ ਅਲੱਗ ਬਣੀ ਹੋਈ ਹੈ ਜਿੱਥੋਂ ਸਾਨੂੰ ਕਿਤਾਬਾਂ ਮਿਲ ਜਾਂਦੀਆਂ ਹਨ ਅਸੀਂ ਜੀ ਕਿਤਾਬਾਂ ਪੜ੍ਹਨੀਆਂ ਪਸੰਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ